ਮੇਰਾ ਨਾਮ ਰਾਘਵ ਹੈ ਮੈਂ ਪਠਾਨਕੋਟ ਸ਼ਹਿਰ ਦਾ ਰਹਿਣ ਵਾਲਾ ਹਾਂ ਜੇਕਰ ਗੱਲ ਕਰੀਏ ਕਿ ਭੰਗੜੇ ਵਿੱਚ ਕਿਹੜੇ ਗੀਤਾਂ 'ਤੇ ਭੰਗੜਾ ਕੀਤਾ ਜਾ ਸਕਦਾ ਹੈ ਤਾਂ ਮੈਂ ਕਹਿੰਦਾ ਹਾਂ ਕਿ ਜ਼ਿਆਦਾਤਰ ਭੰਗੜਾ ਢੋਲ 'ਤੇ ਹੀ ਢੋਲ ਦੀ ਬੀਟ 'ਤੇ ਹੀ ਕੀਤਾ ਜਾਂਦਾ ਹੈ ਜੇਕਰ ਗੱਲ ਕਰੀਏ ਪੰਜਾਬੀ ਗੀਤਾਂ ਦੀ ਤਾਂ ਸਿੱਧੂ ਮੂਸੇਵਾਲਾ ਐਮੀ ਵਿਰਕ ਬੱਬੂ ਮਾਨ ਚਮਕੀਲਾ ਇਹਨਾਂ ਸਾਰਿਆਂ ਦੇ ਗੀਤਾਂ 'ਤੇ ਭੰਗੜਾ ਕੀਤਾ ਜਾਂਦਾ ਹੈ ਭੰਗੜਾ ਬਹੁਤ ਪ੍ਰਸਿੱਧ ਨਾਚ ਹੈ ਇਹ ਪੰਜਾਬ ਵਿੱਚ ਬਹੁਤ ਮਸ਼ਹੂਰ ਹੈ ਅਤੇ ਅੱਜ ਕੱਲ੍ਹ ਇਹ ਬਾਹਰਲੇ ਦੇਸ਼ਾਂ 'ਚ ਵੀ ਕੀਤਾ ਜਾ ਸਕਦਾ ਹੈ ਕੀਤਾ ਜਾ ਰਿਹਾ ਹੈ ਹਰ ਕੋਲਜਾਂ ਵਿੱਚ ਢੋਲ 'ਤੇ ਭੰਗੜਾ ਕੀਤਾ ਜਾਂਦਾ ਹੈ ਭੰਗੜਾ ਬਹੁਤ ਮਸ਼ਹੂਰ ਨਾਚ ਹੈ ਹਰ ਇੱਕ ਕੋਲਜ ਵਿੱਚ ਕੋਈ ਵੀ ਫੰਕਸ਼ਨ ਹੋਵੇ ਤਾਂ ਉਸ ਵਿੱਚ ਭੰਗੜਾ ਕੀਤਾ ਹੀ ਜਾਂਦਾ ਹੈ ਸਾਡੇ ਸ਼ਹਿਰ ਵਿੱਚ ਭੰਗੜੇ ਦੇ ਕਈ ਮੁਕਾਬਲੇ ਹੁੰਦੇ ਹਨ ਜਿਨ੍ਹਾਂ ਵਿੱਚ ਕਈ ਪੰਜਾਬੀ ਗੀਤ ਲੱਗੇ ਹੁੰਦੇ ਹੁੰਦੇ ਹਨ ਅਤੇ ਉਹਨਾਂ ਵਿੱਚ ਕਈ ਮੁੰਡੇ ਕੁੜੀਆਂ ਮਿਲ ਕਰ ਭੰਗੜਾ ਪਾਉਂਦੇ ਹਨ ਭੰਗੜੇ ਵਿੱਚ ਕਈ ਬੋਲੀਆਂ ਵੀ ਪੈਂਦੀਆਂ ਹਨ ਜਿਹੜੇ ਪੰਜਾਬੀ ਵਿੱਚ ਕੀਤੀਆਂ ਜਾਂਦੀਆਂ ਹਨ ਪੰਜਾਬੀ ਵਿੱਚ ਬੋਲੀ 'ਤੇ ਭੰਗੜਾ ਬਹੁਤ ਵਧੀਆ ਪੈਂਦਾ ਹੈ